ਹਾਂਜੀ ਸਤਿ ਸ਼੍ਰੀ ਅਕਾਲ ਜੀ ਗਾਬਾ ਟੈਲੀਕਾਮ ਤੋਂ ਬੋਲਦੇ ਜੀ ਸਰ ਅਸੀਂ ਆਪਣਾ ਮੋਬਾਈਲ ਤੁਹਾਡੇ ਕੋਲ ਬੁੱਕ ਕੀਤਾ ਸੀ ਅਤੇ ਪਹਿਲਾਂ ਤਾਂ ਉਹ ਸਾਨੂੰ ਮਿਲਣਾ ਹੀ ਬੜਾ ਲੇਟ ਹੋ ਰਿਹਾ ਜੀ ਸਾਨੂੰ ਤਾਂ ਕਿਸੇ ਵਜ੍ਹਾ ਲਈ ਚਾਹੀਦਾ ਸੀ ਜ਼ਰੂਰੀ ਅਸੀਂ ਚਾਹੁੰਦੇ ਸੀ ਵੀ ਤੁਹਾਡੇ ਤੋਂ ਸਾਨੂੰ ਸਮੇਂ ਸਿਰ ਚੀਜ਼ ਮਿਲ ਜਾਂਦੀ ਤਾਂ ਚੱਲੋ ਸਾਨੂੰ ਵੀ ਵਧੀਆ ਸੀ ਤੁਹਾਡੀ ਵੀ ਦੁਕਾਨ ਦਾ ਵਧੀਆ ਨਾਮ ਬਣਦਾ ਜੀ ਅਤੇ ਚੱਲੋ ਜੇ ਪਹੁੰਚਿਆ ਪਹੁੰਚਿਆ ਲੇਟ ਫੇਟ ਕਰਕੇ 'ਤੇ ਹੁਣ ਜਦੋਂ ਉਹਨੂੰ ਖੋਲ੍ਹ ਰਹੇ ਤਾਂ ਪਹਿਲਾਂ ਤਾਂ ਉੱਪਰ ਉਹਦੇ ਧੂੜ ਜੰਮੀ ਹੋਈ ਆ ਵਿੱਚੋਂ ਖੋਲ੍ਹਦੇ ਵਿੱਚ ਵੀ ਉਹਦੇ ਕੋਈ ਤਾਰ ਇੱਧਰ ਨੂੰ ਕੋਈ ਇੱਧਰ ਨੂੰ ਅਤੇ ਵਿੱਚ ਉਹਦੇ ਨਾ ਤਾਂ ਚਾਰਜਰ ਹੀ ਹੈਗਾ ਜੀ ਅਤੇ ਚੱਲੋ ਚਾਰਜ ਵੀ ਹੋਇਆ ਫਿਰ ਇਹਦੀ ਅਵਾਜ਼ ਵੀ ਠੀਕ ਨਹੀਂ ਹੈਗੀ ਸਪੀਕਰ ਸਪੁਕਰ ਵੀ ਇਹਦੇ ਇੱਦਾਂ ਦਾ ਕੁਛ ਚੰਗਾ ਕੋਈ ਲੱਗਿਆ ਨਹੀਂ ਜਿੱਦਾਂ ਤੁਹਾਡਾ ਨਾਮ ਸੀਗਾ ਸ਼ੋਪ ਦਾ ਬਣਿਆ ਹੋਇਆ ਅਤੇ ਹੁਣ ਸਾਡੀ ਤਾਂ ਤੁਹਾਨੂੰ ਇਹੀ ਬੇਨਤੀ ਆ ਵੀ ਤੁਸੀਂ ਸਾਨੂੰ ਜਾਂ ਤਾਂ ਕੋਈ ਬਦਲ ਕੇ ਹੋਰ ਦਿਓ ਜਾਂ ਫਿਰ ਇਹਦਾ ਕੋਈ ਹੱਲ ਕੋਈ ਚੰਗੇ ਤਰੀਕੇ ਨਾਲ ਤਾਂ ਕਿ ਇਹ ਪਰੋਪਰ ਚੰਗੀ ਤਰ੍ਹਾਂ ਸਾਨੂੰ ਕੰਮ ਦੇ ਸਕੇ ਸਾਨੂੰ ਇੰਨੇ ਪੈਸੇ ਲਾਉਣ ਦਾ ਫਾਇਦਾ ਤਦੇ ਹੋਇਆ ਜੀ ਜੇ ਹੁਣ ਸਾਨੂੰ ਚੀਜ਼ ਵੀ ਨਾ ਚੰਗੀ ਮਿਲੀ ਫਿਰ ਪੈਸੇ ਲਾਉਣ ਦਾ ਵੀ ਕੀ ਫਾਇਦਾ ਜੀ ਅਤੇ ਤੁਹਾਡੀ ਵੀ ਦੁਕਾਨ ਦਾ ਵਧੀਆ ਨਾਮ ਬਣੂਗਾ ਜੀ ਅਸੀਂ ਹੋਰ ਵੀ ਚਾਰ ਗਾਹਕਾਂ ਨੂੰ ਦੱਸਾਂਗੇ ਵੀ ਗਾਬਾ ਟੈਲੀਕਾਮ ਤੋਂ ਤੁਸੀਂ ਵੀ ਖਰੀਦੋ ਚੀਜ਼ਾਂ ਵੀ ਉਹਨਾਂ ਦਾ ਬੀਹੇਵ ਵੀ ਵਧੀਆ ਹੈ ਅਤੇ ਉਹਨਾਂ ਦੇ ਪ੍ਰੋਡਕਟਸ ਵੀ ਵਧੀਆ ਹੈ ਇਸ ਕਰਕੇ ਸਾਡੀ ਸ਼ਿਕਾਇਤ ਨੂੰ ਦੂਰ ਕੀਤਾ ਜਾਵੇ ਧੰਨਵਾਦ ਜੀ